ਪਾਣੀ ਨੂੰ ਸ਼ੁੱਧ ਕਰਨ ਲਈ ਸਾਨੂੰ ਨਾ ਉਹ ਗਰਮ ਕਰਕੇ ਉਬਾਲ ਕੇ ਵੀ ਪਾਣੀ ਨੂੰ ਫਿਲਟਰ 'ਤੇ ਸਾਫ਼ ਕੀਤਾ ਜਾਂਦਾ ਹੈ ਅਤੇ ਉਹ ਪੀਣ ਦੇ ਯੋਗ ਹੋ ਜਾਂਦਾ ਹੈ ਅਤੇ ਦੂਸਰੀ ਗੱਲ ਵੀ ਜੇ ਹੁਣ ਪਾਣੀ ਨੂੰ ਆਪਾਂ ਹੋਰ ਵੀ ਸ਼ੁੱਧ ਕਰਨਾ ਹੋਵੇ ਤਾਂ ਆਪਾਂ ਉਹਦੇ ਵਿੱਚ ਫਟਕੜੀ ਪਾ ਕੇ ਅਤੇ ਪਾਣੀ ਦੇ ਵਿੱਚ ਫਟਕੜੀ ਨੂੰ ਮਿਲਾ ਕੇ ਘੋਲ ਕੇ ਤਾਂ ਵੀ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਹੈ ਅਤੇ ਗਰਮ ਕਰਨ ਨਾਲ ਉਬਾਲਣ ਨਾਲ ਵੀ ਪਾਣੀ ਸ਼ੁੱਧ ਹੋ ਜਾਂਦਾ ਗਾ ਅਤੇ ਹੋਰ ਵੀ ਕਈ ਤਰੀਕੇ ਹੁੰਦੇ ਹਨ ਜੇ ਆਪਾਂ ਪਾਣੀ ਨੂੰ ਅਤੇ ਇੱਕ ਭਰ ਕੇ ਇੱਕ ਲੋਟੇ ਵਿੱਚ ਰੱਖ ਦੇਈਏ ਤਾਂ ਅਤੇ ਪਾਣੀ ਗੰਧਲਾ ਹੁੰਦਾ ਜਿਹੜਾ ਉਹ ਵੀ ਸਾਫ਼ ਹੋ ਜਾਂਦਾ ਹੈਗਾ ਅਤੇ ਸ਼ੁੱਧ ਕਰਨ ਵਾਸਤੇ ਫਟਕੜੀ ਦਾ ਵੀ ਪ੍ਰਯੋਗ ਕੀਤਾ ਜਾਂਦਾ ਅਤੇ ਪਾਣੀ ਨੂੰ ਉਬਾਲ ਕੇ ਵੀ ਉਹ ਗਰਮ ਕਰਕੇ ਉ ਉਸ ਨਾਲ ਵੀ ਪਾਣੀ ਨੂੰ ਸ਼ੁੱਧ ਕੀਤਾ ਜਾ ਸਕਦਾ ਗਾ ਧੰਨਵਾਦ